ਹੈਲੋ ਸਤਿ ਸ਼੍ਰੀ ਅਕਾਲ ਜੀ ਅੱਛਾ ਤੁਸੀਂ ਹੁਣੇ ਹੁਣੇ ਸ਼ਿਫਟ ਹੋਏ ਹੋ ਮੋਹਾਲੀ ਅੱਛਾ ਅੱਛਾ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਤੂੰ ਮੈਂ ਤੁਹਾਨੂੰ ਗਾਈਡ ਕਰ ਦਿੰਦੀ ਹਾਂ ਕਿਉਂਕਿ ਅਸੀਂ ਤਾਂ ਇੱਥੇ ਕਾਫੀ ਸਮੇਂ ਤੋਂ ਰਹਿ ਰਹੇ ਹਾਂ ਮੋਹਾਲੀ ਦੇ ਵਿੱਚ ਅਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿਹੜੇ ਸੈਕਟਰ ਦੇ ਵਿੱਚ ਰਹਿੰਦੇ ਹੋ ਤੁਸੀਂ ਅੱਠ ਫੇਸ ਠੀਕ ਹੈ ਦੇਖੋ ਪਹਿਲਾਂ ਤਾਂ ਮੈਂ ਦੱਸਾਂਗੀ ਕਿ ਅਗਰ ਤੁਸੀਂ ਫ੍ਰੈਸ਼ ਮ ਫ੍ਰੈਸ਼ ਵੈਜੀਟੇਬਲਸ ਲੈਣੀ ਹੈ ਤਾਂ ਉੱਥੇ ਰਿਲਾਇੰਸ ਮਾਰਕੀਟ ਦਾ ਸ਼ੋਰੂਮ ਹੈ ਠੀਕ ਹੈ ਸਰ ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ ਉੱਥੇ ਤੁਹਾਨੂੰ ਹਰੇਕ ਤਰ੍ਹਾਂ ਦੀ ਫ੍ਰੈਸ਼ ਵੈਜੀਟੇਬਲ ਸਬਜ਼ੀਆਂ ਮਿਲ ਜਾਣਗੀਆਂ ਉੱਥੇ ਤੁਹਾਨੂੰ ਠੀਕ ਹੈ ਬਟ ਅਗਰ ਤੁਹਾਨੂੰ ਉਹਨਾਂ ਦੇ ਪ੍ਰਾਈਜ਼ ਥੋੜ੍ਹੇ ਜ਼ਿਆਦਾ ਲੱਗਦੇ ਨੇ ਤਾਂ ਉੱਥੇ ਤੁਹਾਡੇ ਤੁਹਾਡੇ ਇੱਥੇ ਇੱਥੇ ਅੱਠ ਫੇਸ ਦੇ ਵਿੱਚ ਮੰਡੀ ਵੀ ਲੱਗਦੀ ਹੈ ਜੋ ਹਫ਼ਤੇ ਦੇ ਵਿੱਚ ਦੋ ਦਿਨ ਲੱਗਦੀ ਹੈ ਤਾਂ ਤੁਸੀਂ ਉੱਥੋਂ ਵੀ ਜਾ ਕੇ ਹੈ ਨਾ ਮਤਲਬ ਘੱਟ ਸਸਤੇ ਸਸਤੇ ਪ੍ਰਾਈਜ਼ ਦੇ ਉੱਤੇ ਸ ਸਬਜ਼ੀਆਂ ਲੈ ਸਕਦੇ ਹੋ ਠੀਕ ਹੈ ਅਤੇ ਇਹਦੇ ਦਿਨ ਹੁੰਦੇ ਨੇ ਬੁੱਧਵਾਰ ਅਤੇ ਸ਼ਨੀਵਾਰ ਇਹ ਦੋ ਦਿਨ ਹੀ ਮੰਡੀ ਲੱਗਦੀ ਹੈ ਤੁ ਤੁਸੀਂ ਉੱਥੇ ਆਪਣਾ ਜਾ ਕੇ ਸਬਜ਼ੀਆਂ ਖਰੀਦ ਸਕਦੇ ਹੋ ਹਾਂਜੀ ਕੋਈ ਹੋਰ ਤੁਹਾਨੂੰ ਹੈਲਪ ਦੀ ਲੋੜ ਹੋਵੇ ਤਾਂ ਤੁਸੀਂ ਪੁੱਛ ਸਕਦੇ ਹੋ ਮੈਨੂੰ ਹਾਂਜੀ ਹਾਂਜੀ ਮੈਂ ਹਮੇਸ਼ਾ ਤੁਹਾਡੀ ਸਹਾਇਤਾ ਕਰਨ ਲਈ ਤਿਆਰ ਹਾਂ ਠੀਕ ਹੈ ਤੁਸੀਂ ਮੈਨੂੰ ਕਦੇ ਵੀ ਫੋਨ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ